ਹਾਂਜੀ ਹਾਂਜੀ ਵਧੀਆ ਮੈਮ ਤੁਸੀਂ ਦੱਸੋ ਕੌਣ ਤੁਸੀਂ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਮੈਮ ਮੈਮ ਜਿੱਦਾਂ ਕਿ ਅੱਛਾ ਤੁਹਾਨੂੰ ਕੋਮਲ ਨੇ ਨੰਬਰ ਦਿੱਤਾ ਮੇਰੀ ਫਰੈਂਡ ਸੀ ਹੈ ਉਹ ਮਤਲਬ ਅੱਛਾ ਨਿਊ ਸ਼ਿਫਟਿੰਗ ਕੀਤੀ ਆ ਤੁਸੀਂ ਅੱਛਾ ਅੱਛਾ ਹਾਂਜੀ ਮੈਮ ਜਿੱਦਾਂ ਕਿ ਤੁਸੀਂ ਫੇਰੀ ਵਾਲਿਆਂ ਤੋਂ ਸਬਜ਼ੀ ਨਾ ਲਿਆ ਕਰੋ ਕਿਉਂਕਿ ਫੇਰੀ ਵਾਲੇ ਦੋ ਤਿੰਨ ਦਿਨ ਪੁਰਾਣੀਆਂ ਸਬਜ਼ੀਆਂ ਲੈ ਕੇ ਘੁੰਮਦੇ ਰਹਿੰਦੇ ਆ ਤਾਂ ਕਰਕੇ ਉਹ ਤਾਂ ਜਲਦੀ ਖਰਾਬ ਹੋ ਜਾਂਦੀ ਹੈ ਮੈਮ ਤੁਸੀਂ ਇੱਥੇ ਤੋਂ ਹੀ ਲੈ ਲਿਆ ਕਰੋ ਵੈਸੇ ਮੈਂ ਤੁਹਾਡੀ ਹੈਲਪ ਕਰ ਦੂੰਗੀ ਕੋਈ ਨਹੀਂ ਇੱਕ ਅੱਧੀ ਵਾਰ ਮੈਂ ਤੁਹਾਨੂੰ ਦੱਸ ਦੂੰਗੀ ਕਿੱਥੇ ਤੋਂ ਮਿਲਦੀ ਹੈ ਅਤੇ ਤੁਸੀਂ ਲੈ ਲਿਆ ਕਰਿਓ ਜਿੱਦਾਂ ਕਿ ਹੁਣ ਤੁਸੀਂ ਉੱਥੇ ਤੋਂ ਲੈ ਲਿਓ ਇੱਕ ਬੱਸ ਸਟੈਂਡ ਦੇ ਪਿੱਛੇ ਮਤਲਬ ਉਹ ਵੀ ਲੱਗਦਾ ਏ ਸਬਜ਼ੀ ਮੰਡੀ ਲੱਗਦੀ ਹੈ ਬੱਸ ਸਟੈਂਡ ਦਾ ਤੁਹਾਨੂੰ ਪਤਾ ਹੋਣਾ ਨਾ ਨਹੀਂ ਨਹੀਂ ਮੈਮ ਹਫਤੇ 'ਚ ਦੋ ਦਿਨ ਲੱਗਦੀ ਹੈ ਉਹ ਮਤਲਬ ਮੈਨੂੰ ਪਤਾ ਏ ਕਿ ਸੰਡੇ ਨੂੰ ਤਾਂ ਲੱਗਦੀ ਹੈ ਉਹ ਇੱਕ ਪਤਾ ਨਹੀਂ ਸ਼ਾਇਦ ਬੁੱਧਵਾਰ ਨੂੰ ਲੱਗਦੀ ਹੈ ਪਤਾ ਨਹੀਂ ਵੀਰਵਾਰ ਨੂੰ ਲੱਗਦੀ ਹੈ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦੂੰਗੀ ਇੱਕ ਵਾਰੀ ਹਾਂਜੀ ਮੈਮ ਸਬਜ਼ੀਆਂ ਵਧੀਆ ਮਿਲ ਜਾਂਦੀਆ ਪਰ ਨਾ ਥੋੜ੍ਹਾ ਟਾਈਮ ਹੈ ਮਤਲਬ ਜਦੋਂ ਸਵੇਰ ਨੂੰ ਜਦੋਂ ਸੰਡੇ ਐਤਵਾਰ ਨੂੰ ਤਾਂ ਪੱਕਾ ਹੁੰਦੀਆਂ ਹੀ ਹੈ ਬੁੱਧਵਾਰ ਵੀਰਵਾਰ ਦੇ ਮੈਂ ਤੁਹਾਨੂੰ ਕਨਫਰਮ ਕਰਕੇ ਦੱਸ ਦੂੰਗੀ ਮੈਨੂੰ ਪੱਕਾ ਨਹੀਂ ਪਤਾ ਮੈਂ ਤਾਂ ਐਤਵਾਰ ਨੂੰ ਹੀ ਸਬਜ਼ੀਆਂ ਲੈ ਲੈਂਦੀ ਹੁੰਦੀ ਕਿਉਂਕਿ ਐਤਵਾਰ ਮੈਨੂੰ ਛੁੱਟੀ ਹੁੰਦੀ ਹੈ ਅਤੇ ਛੁੱਟੀ ਵਾਲੇ ਦਿਨ ਮੈਂ ਸਬਜ਼ੀਆਂ ਲੈ ਲਈ ਲਿਆਉਂਦੀ ਹੁੰਦੀ ਹੈ ਉਹ ਸਵੇਰ ਨੂੰ ਹੁੰਦੀ ਹੈ ਮਤਲਬ ਪਾ ਮਤਲਬ ਸਵੇਰ ਨੂੰ ਸਾਜਰੇ ਲੱਗ ਜਾਂਦੀ ਆ ਮਤਲਵ ਚਾਰ ਕੁ ਪੰਜ ਵਜੇ ਲੱਗ ਜਾਂਦੀ ਹੈ ਸੱਤ ਅੱਠ ਵਜੇ ਤੱਕ ਹੁੰਦੀ ਹੈ ਅੱਠ ਵਜੇ ਤੱਕ ਹੁੰਦੀ ਹੈ ਹਾਂਜੀ ਅਤੇ ਸ਼ਾਮ ਹਾਂਜੀ ਹਾਂਜੀ ਮੈਮ ਉੱਥੇ ਮਿਲ ਜਾਂਦੀਆਂ ਇੱਥੇ ਨਾ ਉੱਥੇ ਬੱਸ ਸਟੈਂਡ ਤੋਂ ਪਿੱਛੇ ਨਾ ਇੱਕ ਮਤਲਬ ਉਹ ਹੈ ਮਤਲਬ ਭਾਈ ਹੈ ਮਤਲਬ ਉਹ ਵਧੀਆ ਸਬਜ਼ੀਆਂ ਦਿੰਦਾ ਔਰਗੈਨਿਕ ਸਬਜ਼ੀਆਂ ਹੁੰਦੀਆਂ ਉਹਦੀਆਂ ਕੋਈ ਵੀ ਉਹ ਮਤਲਬ ਉਹ ਨਹੀਂ ਕਰਦਾ ਜਿੱਦਾਂ ਕਿ ਸਪਰੇਹਾਂ ਸਪਰੁਹਾਂ ਅੱਜ ਕੱਲ੍ਹ ਕਰਕੇ ਸਬਜ਼ੀਆਂ ਉਹ ਕਰ ਦਿੰਦੇ ਕੋਈ ਨਹੀਂ ਹੈ ਔਰਗੈਨਿਕ ਖੇਤੀ ਕਰਦਾ ਉਹ ਭਾਈ ਕਿਉਂਕਿ ਉਹ ਆਪਣੀਆਂ ਸਬਜ਼ੀਆਂ ਵੇਚਦਾ ਉੱਥੇ ਤੋਂ ਲੈ ਲਿਓ ਜੇ ਤੁਸੀਂ ਲੈਣੀ ਹੋਈ ਹਾਂਜੀ ਨਹੀਂ ਰੇਟ ਤਾਂ ਮੈਮ ਠੀਕ ਹੀ ਹੁੰਦੇ ਆ ਜੇ ਤੁਸੀਂ ਉਹ ਤੋਂ ਲਉਂਗੇ ਨਾ ਕਿਆ ਕਹਿੰਦੇ ਹੁੰਦੇ ਉਹਨੂੰ ਸਬਜ਼ੀ ਮੰਡੀ ਤੋਂ ਲਉਗੇ ਸਬਜ਼ੀ ਮੰਡੀ ਤੋਂ ਸਬਜ਼ੀ ਮੰਡੀ ਤੋਂ ਤਾਂ ਰੇਟ ਠੀਕ ਹੀ ਹੁੰਦੇ ਹੈ ਜਦੋਂ ਤੁਸੀਂ ਸਵੇਰੇ ਸੱਜਰੇ ਜਲਦੀ ਜਾਓਗੇ ਹੈ ਨਾ ਅਤੇ ਤੁਹਾਨੂੰ ਵਧੀਆ ਮਿਲ ਜਾਉਗੇ ਰੇਟ ਵੀ ਮਤਲਬ ਠੀਕ ਹੁੰਦੇ ਆ ਹਾਂਜੀ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੂੰਗੀ ਤੁਸੀਂ ਮੇਰੇ ਨਾਲ ਚੱਲ ਪਿਓ ਫਿਰ ਮੈਂ ਤੁਹਾਨੂੰ ਲਿਜਾ ਕੇ ਦਵਾ ਦੂੰਗੀ ਫਿਰ ਤੁਸੀਂ ਉਸ ਤੋਂ ਬਾਅਦ ਆਪੇ ਲੈ ਹੀ ਲਉਗੇ ਵੈਸੇ ਮੈਂ ਤਾਂ ਜ਼ਿਆਦਾਤਰ ਐਤਵਾਰ ਨੂੰ ਹੀ ਲੈਂਦੀ ਹੁੰਦੀ ਨਾ ਹਾਂਜੀ ਐਤਵਾਰ ਨੂੰ ਹੀ ਲੈਂਦੀ ਹੁੰਦੀ ਮੈਂ ਹਾਂਜੀ ਹਾਂਜੀ ਮੈਮ ਕੋਈ ਨਹੀਂ ਫਿਰ ਮੈਂ ਤੁਹਾਨੂੰ ਲੇੈ ਜੂੰਗੀ ਅਤੇ ਦੱਸ ਦੂੰਗੀ ਹਾਂਜੀ ਚਲੋ ਮੈਮ ਕਰ ਲਿਓ ਫਿਰ ਜੇ ਤੁਹਾਨੂੰ ਕੋਈ ਹੋਰ ਮਦਦ ਚਾਹੀਦੀ ਹੋਈ ਠੀਕ ਹੈ ਮੈਮ ਓਕੇ